ਖੇਡਾਂ ਵਿੱਚ ਹਿੱਸਾ ਲੈਣ ਲਈ ਯੋਜਨਾ ਅਤੇ ਵਿਚਾਰਾਂ ਨੂੰ ਸਮੂਹ ਤੌਰ 'ਤੇ ਪੇਸ਼ ਕਰੋ ਅਤੇ ਸਬੂਤ ਨਾਲ ਸਮਰਥਨ ਕਰੋ ਹੋਰ ਹਾਂ ਤੋਰਦਿਆਂ ਸਹੂਲਤਾਂ ਉਪਲਬਧ ਹੋਰ ਨਹੀਂ ਹੋਣ ਦੇ ਕਾਰਨ ਤੁਹਾਨੂੰ ਸੰਭਾਵਨਾ ਅਨੁਸਾਰ ਹੋਰ ਸੰਖੇਪ ਲਈ ਸਵਤਾਂ ਦੀ ਖੋਜ ਕਰਨੀ ਚਾਹੀਦੀ ਹੈ ਜਿਵੇਂ ਅਨਲਾਇਨ ਡੇਟਾ ਵੀਸੀਜ ਲਾਈਬ੍ਰੇਰੀਆਂ ਜਾਂ ਫਿਰ ਮਾਹਰ ਰੱਖਣ ਵਾਲੇ ਵਿਸ਼ਾਗਤ ਦੀ ਮਦਦ ਲੈਣੀ ਚਾਹੀਦੀ ਹੈ